ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰੂ ਨਾਨਕ ਟਰੈਵਲ ਏਜੰਸੀ ਤੋਂ ਬੋਲ ਰਹੇ ਹੋ ਜੀ ਹਾਂਜੀ ਅਸੀਂ ਕੱਲ੍ਹ ਨੂੰ ਸ਼ਾਮ ਨੂੰ ਮਾਨਸਾ ਤੋਂ ਅੰਮ੍ਰਿਤਸਰ ਸਾਹਿਬ ਜਾਣਾ ਜੀ ਅਤੇ ਤੁਹਾਡੀ ਟੈਕਸੀ ਬੁੱਕ ਕਰਵਾਈ ਹੋਈ ਹੈ ਅਸੀਂ ਅਸੀਂ ਤੁਹਾਨੂੰ ਪੁੱਛ ਰਹੇ ਸੀ ਕਿ ਜਿਹੜਾ ਵੀ ਅਸੀਂ ਤੁਹਾਡੇ ਇੱਥੋਂ ਜਾਣ ਦਾ ਰਸਤੇ ਦਾ ਚਾਰ ਘੰਟਿਆਂ ਦੇ ਤੁਹਾਡੇ ਪੈਸੇ ਬਣਨਗੇ ਉਹਦਾ ਭੁਗਤਾਨ ਅਸੀਂ ਤੁਹਾਡੇ ਡਰੈਵਰ ਨੂੰ ਔਨਲਾਈਨ ਨਹੀਂ ਕਰ ਸਕਦੇ ਅਸੀਂ ਉਹਨੂੰ ਨਕਦ ਹੀ ਦੇ ਸਕਦੇ ਹਾਂ ਜੋ ਤੁਸੀਂ ਲਾ ਪਿਛਲੇ ਸਮੇਂ ਸਾਡੇ ਨਾਲ ਡਰੈਵਰ ਭੇਜਿਆ ਸੀ ਉਹਨੇ ਸਾਡੇ ਤੋਂ ਪੈਸੇ ਨਕਦ ਹੀ ਲਏ ਸੀ ਅਗਰ ਡਰੈਵਰ ਉਹ ਹੀ ਹੈ ਉਹ ਤੁਸੀਂ ਉਹ ਹੀ ਡਰੈਵਰ ਨੂੰ ਭੇਜ ਰਹੇ ਹੋ ਤਾਂ ਠੀਕ ਹੈ ਅਗਰ ਤੁਸੀਂ ਕਿਸੇ ਹੋਰ ਡਰੈਵਰ ਨੂੰ ਭੇਜ ਰਹੇ ਹੋ ਤਾਂ ਕਿਰਪਾ ਕਰਕੇ ਉਹਨੂੰ ਦੱਸ ਦਿੱਤਾ ਜਾਵੇ ਕਿ ਸਾਡੇ ਕੋਲ ਔਨਲਾਈਨ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪੈਸੇ ਨਹੀਂ ਟ੍ਰਾਂਸਫਰ ਹੋ ਸਕਦੇ ਅਸੀਂ ਉਹਨੂੰ ਨਕਦ ਹੀ ਦੇ ਸਕਦੇ ਹਾਂ ਜੇਕਰ ਪੁਰਾਣਾ ਡਰੈਵਰ ਹੀ ਹੈ ਤਾਂ ਠੀਕ ਹੈ ਅਗਰ ਤੁਸੀਂ ਕੋਈ ਨਵਾਂ ਡਰੈਵਰ ਭੇਜ ਭੇਜ ਰਹੇ ਹੋ ਤਾਂ ਉਹਨੂੰ ਕਿਰਪਾ ਕਰਕੇ ਇਹ ਸਮਝਾ ਦਿੱਤਾ ਜਾਵੇ ਤਾਂ ਜੋ ਸਾਨੂੰ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਧੰਨਵਾਦ ਜੀ